ਜੀ ਹਾਂ ਅਸੀਂ ਆਪਣੇ ਕੈਮਰੇ ਦੀ ਵਰਤੋਂ ਕਰਦੇ ਹੋਏ ਰੀਲਾਂ ਅਤੇ ਸ਼ਾਰਟਸ ਨੂੰ ਵੀ ਸ਼ੂਟ ਕਰਦੇ ਹਾਂ ਇਹ ਫੋਟੋ ਖਿੱਚਣ ਤੋਂ ਬਾਅਦ ਵਗੈਰਾ ਹੈ ਕਿਉਂਕਿ ਰੀਲਾਂ ਅਤੇ ਸ਼ੋਟਸ ਬਣਾਉਣ ਲਈ ਸਾਨੂੰ ਪੂਰੀ ਦੀ ਪੂਰੀ ਸਕ੍ਰਿਪਟ ਚਾਹੀਦੀ ਹੁੰਦੀ ਹੈ ਜਿਸ ਤਰ੍ਹਾਂ ਜਿਸ ਰਾਹੀਂ ਆਪਾਂ ਉਸ ਸ਼ੋਰਟ ਜਾਂ ਰੀਲ ਵਿੱਚ ਇੱਕ ਕਹਾਣੀ ਆਪਣੀ ਓਡੀਅੰਸ ਤੱਕ ਪਹੁੰਚਾ ਪਾਈਏ ਜਿਸ ਨਾਲ ਉਹ ਸਾਡੇ ਨਾਲ ਕਨੈਕਟ ਕਰ ਸਕੇ ਅਤੇ ਉਸ ਰੀਲ ਅਤੇ ਜਾਂ ਫਿਰ ਸ਼ੋਰਟ ਨੂੰ ਪੂਰਾ ਦੇਖੇ ਰੀਲਾਂ ਅਤੇ ਸ਼ੋਟਸ ਫੋਟੋਆਂ ਖਿੱਚਣ ਤੋਂ ਬਹੁਤ ਅਲੱਗ ਹੈ ਫੋਟੋ ਖਿੱਚਣ ਲਈ ਸਾਨੂੰ ਇੱਕ ਜਗ੍ਹਾ 'ਤੇ ਸਥਿਰ ਖੜ੍ਹੇ ਹੋਣਾ ਪੈਂਦਾ ਹੈ ਅਤੇ ਮੁਸਕਰਾ ਕੇ ਜਾਂ ਰੋ ਕੇ ਕੁਛ ਵੀ ਕਰਕੇ ਕਿਸੇ ਪੋਜ਼ ਨੂੰ ਬਣਾ ਕੇ ਫੋਟੋ ਖਿਚਾਉਣੀ ਹੁੰਦੀ ਆ ਪਰ ਰੀਲਾਂ ਬਣਾਉਣ ਲਈ ਜਾਂ ਸ਼ੋਟਸ ਬਣਾਉਣ ਲਈ ਸਾਨੂੰ ਬਹੁਤ ਹੀ ਅਲੱਗ ਅਲੱਗ ਚੀਜ਼ਾਂ ਕਰਨੀਆ ਪੈਂਦੀਆਂ ਹਨ ਇੱਕ ਰੀਲ ਬਣਾਉਣ ਲਈ ਉਸ ਵਿੱਚ ਜਾਂ ਤਾਂ ਕੋਈ ਕਹਾਣੀ ਹੋਣੀ ਚਾਹੀਦੀ ਹੈ ਜਾਂ ਫਿਰ ਕੋਈ ਸਾਡਾ ਇਸ ਤਰ੍ਹਾਂ ਦੀ ਪ੍ਰਤਿਭਾ ਹੋਣੀ ਚਾਹੀਦੀ ਹੈ ਜਿਸ ਨਾਲ ਲੋਕਾਂ ਨੂੰ ਐਟਰਟੇਨਮੈਂਟ ਮਿਲੇ ਮਨੋਰੰਜਨ ਮਿਲੇ ਕਿਸੇ ਵੀ ਰੀਲ ਵਿੱਚ ਆਪਾਂ ਕੋਈ ਚੁਟਕਲਾ ਸੁਣਾ ਸਕਦੇ ਹਾਂ ਆਪਾਂ ਨੱਚ ਕੇ ਦਿਖਾ ਸਕਦੇ ਹਾਂ ਆਪਾਂ ਗਾ ਕੇ ਦਿਖਾ ਸਕਦੇ ਹਾਂ ਜਾਂ ਫਿਰ ਆਪਾਂ ਕੋਈ ਇਸ ਤਰ੍ਹਾਂ ਦਾ ਕੋਟ ਜਾਂ ਫਿਰ ਥੋਟ ਪਾ ਸਕਦੇ ਹਾਂ ਜਿਹਨਾਂ ਨੂੰ ਜਿਸ ਨੂੰ ਪੜ੍ਹ ਕੇ ਲੋਕਾਂ ਨੂੰ ਚੰਗਾ ਲੱਗੇ ਰੀਲਸ ਅਤੇ ਸ਼ੋਰਟਸ ਫੋਟੋਆਂ ਤੋਂ ਬਹੁਤ ਵੱਖ ਬਸ ਫ਼ਰਕ ਇਹ ਹੈ ਕਿ ਰੀਲਸ ਵਿੱਚ ਵੀਡੀਓ ਜਿਹੜੀ ਚਲਦੀ ਹੈ ਉਹ ਵੀ ਕੁਛ ਇਸ ਤਰ੍ਹਾਂ ਦੀ ਫੋਟੋਆਂ ਦਾ ਸਮ ਗਰੁੱਪ ਹੁੰਦਾ ਹੈ ਜਿਹਨਾਂ ਨੂੰ ਇੱਕ ਤੋਂ ਬਾਅਦ ਇਕ ਖਿੱਚਿਆ ਗਿਆ ਹੁੰਦਾ ਹੈ ਅਤੇ ਉਸ ਰਾਹੀਂ ਆਪ ਸਾਨੂੰ ਲੱਗਦਾ ਹੈ ਕਿ ਸਾਡੇ ਸਾਹਮਣੇ ਇੱਕ ਵੀਡੀਓ ਚੱਲ ਰਹੀ ਆ ਸ਼ੋਟਸ ਅਤੇ ਰੀਲਸ ਅੱਜ ਦੇ ਜ਼ਮਾਨੇ ਦਾ ਟੈਲੀਵਿਜ਼ਨ ਬਣ ਗਈਆਂ ਜਿਸ ਤਰ੍ਹਾਂ ਉੱਨੀ ਸੋ ਅੱਸੀ ਦੇ ਦਸ਼ਕ ਵਿੱਚ ਟੈਲੀਵਿਜ਼ਨ ਬਹੁਤ ਵੇਖਿਆ ਜਾਂਦਾ ਸੀ ਅੱਜ ਦੇ ਜ਼ਮਾਨੇ ਵਿੱਚ ਰੀਲਾਂ ਅਤੇ ਸ਼ਾਰਟਸ ਬਹੁਤ ਵੇਖੇ ਜਾਂਦੇ ਹਨ ਆਪਣੇ ਕੈਮਰੇ ਦੀ ਵਰਤੋਂ ਰਾਹੀਂ ਆਪਾਂ ਰੀਲਸ ਅਤੇ ਸ਼ੋਟਸ ਨੂੰ ਸ਼ੂਟ ਕਰਦੇ ਹਾਂ ਅਤੇ ਉਹਨਾਂ ਨੂੰ ਲੋਕਾਂ ਨੂੰ ਦਿਖਾਉਂਦੇ ਹਾਂ ਅਤੇ ਲੋਕਾਂ ਦੀ ਵਾਹ ਵਾਹੀ ਲੈਂਦੇ ਹਾਂ ਜੇ ਲੋਕਾਂ ਨੂੰ ਉਹ ਪਸੰਦ ਆਏਗੀ ਆਏਗੀ ਅਤੇ ਉਹ ਉਸ ਨੂੰ ਲਾਇਕ ਕਰਨਗੇ ਪਰ ਜੇ ਉਹਨਾਂ ਨੂੰ ਉਹ ਪਸੰਦ ਨਹੀਂ ਆਏਗੀ ਉਸ ਵੀਡੀਓ ਨੂੰ ਰਿਪੋਰਟ ਵੀ ਕਰ ਸਕਦੇ ਹਨ ਸਾਨੂੰ ਬਲੋਕ ਵੀ ਕਰ ਸਕਦੇ ਹਨ ਰੀਲਜ਼ ਅਤੇ ਸ਼ੋਟਸ ਅੱਜ ਦੇ ਜ਼ਮਾਨੇ ਵਿੱਚ ਬਹੁਤ ਚਲਦੀਆਂ ਹਨ ਅਤੇ ਫੋਟੋਓਗਰਾਫੀ ਨੂੰ ਰਿਪਲੇਸ ਕਰ ਦਿੱਤਾ ਹੈ ਇਸ ਤਰ੍ਹਾਂ ਤਾਂ ਮੈਂ ਨਹੀਂ ਕਹਿ ਸਕਦਾ ਕਿਉਂਕਿ ਫੋਟੋਗ੍ਰਾਫੀ ਵੀ ਆਪਣੀ ਤਰ੍ਹਾਂ ਨਾਲ ਇੱਕ ਨਵਾਂ ਹੀ ਪ੍ਰੋਫੈਸ਼ਨ ਹੈ ਪਰ ਜਿਹੜੀ ਰੀਲਜ਼ ਅਤੇ ਸ਼ੋਰਟਸ ਹਨ ਉਹ ਐਂਟਰਟੇਨਮੈਂਟ ਦੀ ਦ੍ਰਿਸ਼ਟੀ ਰਾਹੀਂ ਬਹੁਤ ਵਧੀਆ ਸਰੋਤ ਹੈ